ਮਾਰਸ਼ਲ ਆਰਟ ਲੜਾਈ ਦਾ ਹੀ ਨਹੀਂ ਬਲਕਿ ਜ਼ਿੰਦਗੀ ਜੀਣ ਦਾ ਵੀ ਇੱਕ ਤਰੀਕਾ ਹੈ ਇਹਦੇ ਵਿੱਚ ਅਨੁਸ਼ਾਸਨ ਅਤੇ ਨਿਯਮ ਸਭ ਤੋਂ ਮਹੱਤਵਪੂਰਨ ਹਿੱਸਾ ਹਨ ਜਿਹਨਾਂ ਤੋਂ ਬਿਨਾਂ ਕੋਈ ਵੀ ਯੋਧਾ ਸਫਲ ਨਹੀਂ ਹੋ ਸਕਦਾ ਅਨੁਸ਼ਾਸਨ ਮਾਰਸ਼ਲ ਆਰਟਿਸਟ ਦੇ ਆਤਮ ਨਿਯੰਤਰਣ ਸੰਯਮ ਅਤੇ ਆਦਰਸ਼ ਨੂੰ ਵਧਾਉਂਦਾ ਹੈ ਜਦ ਕਿ ਨਿਯਮ ਉਸ ਨੂੰ ਸੁਰੱਖਿਅਤ ਅਤੇ ਨਿਰਵਿਘਨ ਅਭਿਆਸ ਲਈ ਮਦਦ ਕਰਦੇ ਹਨ ਅਨੁਸ਼ਾਸਨ ਯੋਧੇ ਦੀ ਅਸਲੀ ਤਾਕਤ ਹੈ ਅਨੁਸ਼ਾਸਨ ਹੀ ਮਾਰਸ਼ਲ ਆਰਟਿਸਟ ਦੀ ਅਸਲੀ ਤਾਕਤ ਹੁੰਦਾ ਹੈ ਕਿਉਂਕਿ ਇਹ ਉਸ ਨੂੰ ਸਵੈ ਨਿਯੰਤਰਣ ਹਿੰਮਤ ਅਤੇ ਦ੍ਰਿੜਤਾ ਪੈਦਾ ਕਰਦਾ ਹੈ ਅਨੁਸ਼ਾਸਨ ਤੋਂ ਬਿਨਾਂ ਕੋਈ ਵੀ ਵਿਅਕਤੀ ਲੜਾਈ ਵਿੱਚ ਤਕਨੀਕ ਤਾਂ ਸਿੱਖ ਸਕਦਾ ਹੈ ਪਰ ਉਹ ਆਪਣੇ ਆਪ 'ਤੇ ਕਾਬੂ ਨਹੀਂ ਕਰ ਸਕਦਾ ਮਾਰਸ਼ਲ ਆਰਟ ਦੇ ਵਿੱਚ ਅਨੁਸ਼ਾਸਨ ਜਿਵੇਂ ਕਿ ਨਿਯਮਿਤ ਅਭਿਆਸ ਸਵੈ ਨਿਯੰਤਰਣ ਆਗਿਆਕਾਰੀ ਅਤੇ ਸਧਾਰਨਤਾ ਨੂੰ ਦਿਖਾਉਂਦਾ ਹੈ ਨਿਯੰਤਰਨ ਅਭਿਆਸ ਦੇ ਨਾਲ ਬਾਰ ਬਾਰ ਦੁਹਰਾਉਣ ਨਾਲ ਵਿਅਕਤੀ ਸਹੀ ਅਤੇ ਜਿੰਮੇਵਾਰ ਤਰੀਕੇ ਨਾਲ ਆਪਣੀ ਯੋਗਤਾਵਾਂ ਨੂੰ ਵਿਕਸਿਤ ਕਰ ਦਿੰਦਾ ਹੈ ਸਵੈ ਨਿਯੰਤਰਨ ਸਿਖਾਉਂਦਾ ਹੈ ਆਪਣੇ ਗੁੱਸੇ 'ਤੇ ਕਾਬੂ ਪਾਉਣਾ ਅਤੇ ਆਪਣੀ ਤਾਕਤ ਨੂੰ ਸਹੀ ਦਿਸ਼ਾ ਵਿੱਚ ਲਗਾਉਣਾ ਆਗਿਆਕਾਰੀ ਗੁਰੂ ਦੇ ਹੁਕਮ ਮੰਨਣ ਅਤੇ ਸਹੀ ਤਰੀਕੇ ਨਾਲ ਹਰੇਕ ਹਦਾਇਤ 'ਤੇ ਚੱਲਣ ਦੀ ਲੋੜ ਨੂੰ ਦਰਸ਼ਾਉਂਦਾ ਹੈ ਸਧਾਰਨਤਾ ਸਿਖਾਉਂਦੀ ਹੈ ਕਿ ਹਮੇਸ਼ਾ ਨਿਮਰ ਰਹਿਣਾ ਅਤੇ ਆਪਣੇ ਗਿਆਨ 'ਤੇ ਹੰਕਾਰ ਨਾ ਕਰਨਾ ਸਗੋਂ ਨਵੀਆਂ ਚੀਜ਼ਾਂ ਸਿੱਖਣ ਦੀ ਇੱਛਾ ਨਾਲ ਅੱਗੇ ਵਧਾਉਂਦਾ ਹੈ ਨਿਯਮ ਅਲੱਗ ਅਲੱਗ ਹੋ ਸਕਦੇ ਹਨ ਜਿਸ ਵਿੱਚ ਦੁਸ਼ਮਣ ਦੀ ਇੱਜ਼ਤ ਕਰਨਾ ਕੋਚ ਦੀ ਇੱਜ਼ਤ ਕਰਨਾ ਸੁਰੱਖਿਆ ਦੇ ਨਿਯਮਾਂ ਦੀ ਪਾਲਣਾ ਕਰਨਾ ਕਲਾਸ ਨਿਯਮਾਂ ਦੀ ਪਾਲਣਾ ਕਰਨਾ ਯੋਧਿਆਵਾਂ ਦੇ ਆਦਰਸ਼ ਦੀ ਵੀ ਪਾਲਣਾ ਕਰਨ ਦੀ ਹਿਦਾਇਤ ਦਿੰਦਾ ਹੈ ਜਿਵੇਂ ਚਾਹੇ ਦੋਸਤ ਹੋਵੇ ਜਾਂ ਦੁਸ਼ਮਣ ਜਾਂ ਚਾਹੇ ਲੜਾਈ ਹੋਵੇ ਅਭਿਆਸ ਹੋਵੇ ਹਮੇਸ਼ਾ ਆਪਣੇ ਦੋਸਤ ਦੀ ਇੱਜ਼ਤ ਕਰਨੀ ਚਾਹੀਦੀ ਹੈ ਸੈਂਸੇ ਜਾਂ ਗੁਰੂ ਦੇ ਨਿਯਮ ਨੂੰ ਮੰਨਣਾ ਚਾਹੀਦਾ ਹੈ ਅਤੇ ਉਹਨਾਂ ਦੀ ਸਲਾਹ ਅਨੁਸਾਰ ਹੀ ਚੱਲਣਾ ਚਾਹੀਦਾ ਹੈ ਸੁਰੱਖਿਆ ਨਿਯਮਾਂ ਨੂੰ ਵੀ ਪਾਲਣਾ ਕਰਨੀ ਚਾਹੀਦੀ ਹੈ ਹਮੇਸ਼ਾ ਸੁਰੱਖਿਅਤ ਤਰੀਕਿਆਂ ਦੇ ਨਾਲ ਹੀ ਚੱਲਣਾ ਚਾਹੀਦਾ ਹੈ ਕਲਾਸ ਨਿਯਮਾਂ ਨੂੰ ਅਪਣਾਉਣਾ ਹੈ ਅਤੇ ਚੁੱਪ ਚਾਪ ਰਹਿਣਾ ਜਿਹਦੇ ਵਿੱਚ ਸਾਫ ਸੁਥਰਾ ਅਤੇ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੋ ਜਾਂਦੀ ਹੈ ਜੋਧਾਵਾਂ ਦੇ ਆਦਰਸ਼ ਜਿਵੇਂ ਕਦੇ ਆਪਣੇ ਵਿਦਿਆਰਥੀ ਜਾਂ ਦੋਸਤਾਂ ਉੱਤੇ ਮਾਰਸ਼ਲ ਆਰਟ ਦਾ ਗਲਤ ਇਸਤੇਮਾਲ ਨਾ ਕਰਨਾ ਅਤੇ ਉਹਨਾਂ ਦਾ ਕੋਈ ਐਸਾ ਦੁਰਉਪਯੋਗ ਨਾ ਹੋਵੇ ਇਸ ਚੀਜ਼ ਦਾ ਧਿਆਨ ਦਿੱਤਾ ਜਾਂਦਾ ਹੈ